ਮੈਂ ਬਚਪਨ ਦੇ ਵਿੱਚ ਫੜਨ ਭੜ੍ਹੀਚੀ ਲੁਕਣ ਮੀਚੀ ਬਾਰਾਂ ਗੀਟੀ ਗੁੱਡੇ ਪਟੋਲੇ ਇਹ ਸਭ ਖੇਡਦੀ ਹੁੰਦੀ ਸੀ ਜਿਸ ਦੇ ਵਿੱਚ ਸਭ ਤੋਂ ਪਿਆਰਾ ਖੇਡ ਮੇਰਾ ਗੁੱਡੀਆਂ ਪਟੋਲੇ ਹੁੰਦਾ ਸੀ ਜੋ ਅਸੀਂ ਮੈਂ ਅਤੇ ਮੇਰੀ ਭੈਣ ਮਿਲ ਕੇ ਦੋਵੇਂ ਅਸੀਂ ਆਪ ਦੇ ਹੱਥੀ ਗੁੱਡੀਆਂ ਪਟੋਲੇ ਤਿਆਰ ਕਰਦੇ ਸੀ ਜਿਸ ਨੂੰ ਖੇਡ ਕੇ ਬਹੁਤ ਹੀ ਚੰਗਾ ਲੱਗਦਾ ਸੀ ਅਤੇ ਆਨੰਦ ਮਿਲਦਾ ਸੀ ਹੁਣ ਉਹ ਜਦੋਂ ਵੀ ਮੈਂ ਮਤਲਬ ਯਾਦ ਕਰਦੀ ਹਾਂ ਉਹ ਖੇਡ ਤਾਂ ਮੈਨੂੰ ਬਹੁਤ ਯਾਦ ਆਉਂਦੀ ਹੈ ਗੁੱਡੀਆਂ ਪਟੋਲਿਆਂ ਦੀ ਮੇਰੀ ਇੱਕ ਬੇਟੀ ਹੈ ਜਿਸ ਨੂੰ ਦੇਖ ਕੇ ਮੈਨੂੰ ਗੁੱਡੀਆਂ ਪਟੋਲਿਆਂ ਦੀ ਬਹੁਤ ਯਾਦ ਆਉਂਦੀ ਹੈ ਇਸ ਕਰਕੇ ਮਤਲਬ ਹੁਣ ਵੀ ਮੇਰੇ ਘਰ ਦੇ ਵਿੱਚ ਜੋ ਬੱਚੇ ਹਨ ਉਹ ਬਾਰਾਂ ਗੀਟੀ ਅਤੇ ਲੁਕਣ ਮੀਚੀ ਖੇਡਦੇ ਹਨ ਜਿਹਨਾਂ ਨੂੰ ਗੁੱਡੀਆਂ ਪਟੋਲੇ ਦਾ ਬਿਲਕੁਲ ਵੀ ਨਹੀਂ ਪਤਾ ਕਿਉਂਕਿ ਇਸ ਕਰਕੇ ਨਹੀਂ ਪਤਾ ਕਿਉਂਕਿ ਜੋ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਉਹਨਾਂ ਨੂੰ ਆਹ ਮੋਬਾਈਲ ਫੋਨਾਂ ਨੇ ਗੁੱਡੀਆਂ ਪਟੋਲਿਆਂ ਦਾ ਜੋ ਵੀ ਖੇਡ ਹੁੰਦਾ ਹੈ ਉਹ ਸਭ ਮੋਬਾਇਲ ਫੋਨਾਂ ਨੇ ਖੋ ਲਿਆ ਹੈ ਜਿਸ ਕਰਕੇ ਬੱਚੇ ਸਾਡੇ ਬਚਪਨ ਦੀਆਂ ਖੇਡਾਂ ਨੂੰ ਭੁੱਲ ਚੁੱਕੇ ਨੇ ਅਤੇ ਉਹ ਆਪਣੇ ਆਪਣੇ ਜੋ ਬਚਪਨ ਹੈ ਉਹ ਫੋਨ ਦੇ ਰਾਹੀਂ ਖਰਾਬ ਕਰ ਰਹੇ ਹਨ ਅਤੇ ਉਹ ਫੋਨ ਦੇ ਵਿੱਚ ਹੀ ਕੁਛ ਨਾ ਕੁਛ ਇੱਦਾਂ ਦਾ ਦੇਖਦੇ ਹਨ ਕਿਉਂਕਿ ਉਹਨਾਂ ਨੂੰ ਸਾਡੇ ਜੋ ਬਚਪਨ ਦੀਆਂ ਖੇਡਾਂ ਹਨ ਉਹਨਾਂ ਬਾਰੇ ਕੁਛ ਨਹੀਂ ਪਤਾ ਇਸ ਕਰਕੇ ਮੈਂ ਆਪਣੀ ਬੇਟੀ ਨੂੰ ਬਹੁਤ ਜ਼ਿਆਦਾਤਰ ਆਪਣੇ ਬਚਪਨ ਦੀਆਂ ਖੇਡਾਂ ਬਾਰੇ ਦੱਸਦੀ ਹਾਂ ਜਿਸ ਵਿੱਚੋਂ ਉਹ ਮੇਰੇ ਬਚਪਨ ਦੀ ਇੱਕ ਖੇਡ ਹੈ ਬਾਰਾਂ ਗੀਟੀ ਉਹ ਬਹੁਤ ਜ਼ਿਆਦਾ ਖੇਡਦੇ ਹਨ ਅਤੇ ਬਾਰਾਂ ਗੀਟੀ ਅਤੇ ਲੁਕਣ ਮੀਚੀ ਖੇਡਦੇ ਹਨ ਜਿਹਨਾਂ ਵਿੱਚੋਂ ਗੁੱਡੀਆਂ ਪਟੋਲੇ ਉਹ ਇਹਨਾਂ ਨੂੰ ਹਾਲੇ ਤੱਕ ਕੁਛ ਨਹੀਂ ਪਤਾ ਜੋ ਮੈਂ ਅੱਜ ਵੀ ਆਪਣੇ ਇਸ ਖੇਡ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਹਾਂ ਕਿ ਗੁੱਡੀਆਂ ਪਟੋਲੇ ਮੇਰੀ ਜ਼ਿੰਦਗੀ ਦਾ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਅਨੋਖਾ ਖੇਡ ਸੀ ਜਿਹਨੂੰ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਹਾਂ